ਸਾਡੇ ਖੇਤਰਾਂ ਵਿੱਚ ਬਹੁਤ ਸਾਰੇ ਕੁਦਰਤੀ ਸਰੋਤ ਹਨ ਜਿਵੇਂ ਮਿੱਟੀ ਰੇਤ ਪਾਣੀ ਇਹਨਾਂ ਸਾਰੇ ਸਰੋਤਾਂ ਨੂੰ ਵਪਾਰ ਵਜੋਂ ਵਰਤਿਆ ਜਾਂਦਾ ਹੈ ਜਿਸ ਤਰ੍ਹਾਂ ਮਿੱਟੀ ਦੀ ਵਰਤੋਂ ਨਾਲ ਭੱਠਿਆਂ ਵਿੱਚ ਇੱਟਾਂ ਬਣਾਉਣ ਦਾ ਕੰਮ ਕੀਤਾ ਜਾਂਦਾ ਹੈ ਇਹ ਇੱਟਾਂ ਚੰਗੇ ਭਾਅ 'ਤੇ ਵਿਕਦੀਆਂ ਹਨ ਜਿਸ ਨਾਲ ਘਰਾਂ ਦੀ ਉਸਾਰੀ ਹੁੰਦੀ ਹੈ ਰੇਤ ਰੇਤ ਵੀ ਇੱਕ ਕੁਦਰਤੀ ਸਰੋਤ ਹੈ ਜਿਸ ਨੂੰ ਦਰਿਆ ਦੇ ਕੰਢੇ ਸਮੁੰਦਰਾਂ ਦੇ ਕੰਢੇ 'ਤੇ ਪ੍ਰਾਪਤ ਕੀਤਾ ਜਾਂਦਾ ਹੈ ਜਿਸ ਦੀ ਵਰਤੋਂ ਨਾਲ ਘਰਾਂ ਦੀ ਉਸਾਰੀ ਹੁੰਦੀ ਹੈ ਰੇਤ ਵੀ ਮਹਿੰਗੇ ਭਾਅ 'ਤੇ ਵੇਚੀ ਜਾਂਦੀ ਹੈ ਪਾਣੀ ਪਾਣੀ ਸਭ ਤੋਂ ਅਹਿਮ ਕੁਦਰਤੀ ਸਰੋਤ ਹੈ ਜਿਸ ਦੀ ਵਰਤੋਂ ਖੇਤਾਂ ਵਿੱਚ ਕੀਤੀ ਜਾਂਦੀ ਹੈ ਉਹ ਫਸਲਾਂ ਜਦ ਤਿਆਰ ਹੁੰਦੀਆਂ ਹਨ ਤਾਂ ਮਹਿੰਗੇ ਭਾਅ 'ਤੇ ਵੇਚੀਆਂ ਜਾਂਦੀਆਂ ਹਨ ਪਾਣੀ ਨੂੰ ਡੈਮਾਂ ਵਿੱਚ ਇਕੱਠਾ ਕਰਕੇ ਬਿਜਲੀ ਪੈਦਾ ਕੀਤੀ ਜਾਂਦੀ ਹੈ ਜਿਸ ਦੀ ਸਪਲਾਈ ਨਾਲ ਪੈਸੇ ਕਮਾਏ ਜਾਂਦੇ ਹਨ ਪਾਣੀ ਦੀ ਵਰਤੋਂ ਨਾਲ ਮੱਛੀਆਂ ਪਾਲਣ ਦਾ ਵਪਾਰ ਵੀ ਕੀਤਾ ਜਾਂਦਾ ਹੈ ਇਹ ਸਾਰੇ ਸਰੋਤ ਵਪਾਰਕ ਗਤੀਵਿਧੀਆਂ ਲਈ ਵਰਤੇ ਜਾਂਦੇ ਹਨ